ਹੈਲੋ ਸਰ ਓਲਾ ਐਪ ਤੋਂ ਬੋਲਦੇ ਸਰ ਮੈਂ ਸਰ ਬਲਵਿੰਦਰ ਸਿੰਘ ਬੋਲਦਾ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਵੀ ਮੇਰੀ ਨਾ ਚੰਡੀਗੜ੍ਹ ਤੋਂ ਫਲੈਟ ਰਾਤ ਦੋ ਵਜੇ ਅਤੇ ਮੈਨੂੰ ਕੈਬ ਚਾਹੀਦੀ ਸੀ ਮੈਨੂੰ ਕੈਬ ਬੁੱਕ ਕਰਵਾਉਣੀ ਸੀਗੀ ਮੈਨੂੰ ਤੁਸੀਂ ਉਸ ਕੈਬ ਮਤਲਬ ਕੈਬ ਦਾ ਕੀ ਚਾਰਜਿਸ ਹੁੰਦਾ ਹੈਗਾ ਕਿਲੋਮੀਟਰ ਦਾ ਹੁੰਦਾ ਜਾਂ ਉੱਕਾ ਪੱਕਾ ਕੀ ਹੁੰਦਾ ਟੂਲ ਟੈਕਸ ਵਿੱਚ ਹੁੰਦੇ ਜਾਂ ਅਲੱਗ ਹੁੰਦੇ ਸਰ ਅਤੇ ਅੱਛਾ ਇਹ ਮੈਨੂੰ ਟਾਈਮ ਸਿਰ ਟਾਈਮ ਸਿਰ ਟਾਈਮ ਸਿਰ ਪਹੁੰਚ ਪਹੁੰਚਾਦੂਗੀ ਫਲਾਈਟ ਦੇ ਟਾਈਮ 'ਤੇ ਮੈਂ ਮੈਨੂੰ ਪਹੁੰਚਦਾ ਕਰ ਦਊਗੀ ਡਰਾਈਵਰ ਜਿਹੜਾ ਚਾਹੀਦਾ ਆਪਾਂ ਨੂੰ ਕੋਈ ਖਾਂਦਾ ਪੀਂਦਾ ਨਾ ਹੋਵੇ ਨਸ਼ਾ ਪੱਤੇ ਵਾਲਾ ਨਾ ਹੋਵੇ ਸਾਫ ਸੁਥਰਾ ਹੋਵੇ ਸਰ ਥੋੜ੍ਹੇ ਪੈਸੇ ਘੱਟ ਕਰ ਲਓ ਜੀ ਜ਼ਿਆਦਾ ਪੈਸੇ ਮੰਗ ਰਹੇ ਹੋ ਤੁਸੀਂ ਐਕਚੁਲੀ ਮੈਂ ਵੀ ਇਸੇ ਲਾਈਨ 'ਚ ਸੀਗਾ ਅਤੇ ਮੇਰੀ ਫਲੈਟ ਸੀਗੀ ਚੰਡੀਗੜ੍ਹ ਤੋਂ ਦਿੱਲੀ ਲਈ ਅਤੇ ਮੈਂ ਇਸੇ ਕਰਕੇ ਵੀ ਲੈਬ 'ਤੇ ਕੀਤੀ ਮੈਂ ਵੀ ਤੁਹਾਡੇ ਕੋਲ ਜੋ ਵੀ ਕੈਪਸ ਨੇ ਉਹ ਮਤਲਬ ਜੋ ਡਰਾਈਵਰ ਨੇ ਉਹ ਉਹਨਾਂ ਦੇ ਸਾਰੇ ਡੋਕੂਮੈਂਟ ਤੁਹਾਡੇ ਕੋਲ ਹੁੰਦੇ ਆ ਅਤੇ ਹੁਣ ਟਾਈਮ ਸਿਰ ਪਹੁੰਚਾ ਦੇਣ ਅਤੇ ਹੁਣ ਤੁਸੀਂ ਦੱਸੋ ਕਬਕਾ ਲਉਗੇ ਜਾਂ ਮੇਰੇ ਨਾਲ ਵੀ ਕਿਲੋਮੀਟਰ ਦਾ ਹਿਸਾਬ ਰੱਖੋਗੇ ਜੋ ਮੈਨੂੰ ਟਾਈਮ ਸਿਰ ਓਲਾ ਐਪ ਪਹੁੰਚਦੀ ਕਰਦੇ ਅਤੇ ਟੂਲ ਟੈਕਸ ਵਗੈਰਾ ਵੀ ਦੱਸ ਦਿਓ ਜੀ